ਖੇਡਾਂ ਜ਼ਿੰਦਗੀ ਦਾ ਬਹੁਤ ਹੀ ਮਹੱਤਵਪੂਰਨ ਭਾਗ ਹੈ ਖੇਡਾਂ ਖੇਡਦੇ ਰਹਿਣਾ ਚਾਹੀਦਾ ਹੈ ਜਿਸ ਨਾਲ ਸਰੀਰ ਤੰਦਰੁਸਤ ਰਹਿੰਦਾ ਹੈ ਮੈਂ ਵੀ ਖੇਡਦਾ ਰਹਿੰਦਾ ਹਾਂ ਅਤੇ ਦੌੜਾਂ ਲਾਉਂਦਾ ਰਹਿੰਦਾ ਹਾਂ ਹੁਣ ਤਾਂ ਠੰਡ ਦਾ ਮੌਸਮ ਹੋਣ ਕਰਕੇ ਸਵੇਰੇ ਭੱਜਿਆ ਨਹੀਂ ਜਾਂਦਾ ਹਾਂ ਸ਼ਾਮ ਨੂੰ ਮੈਂ ਜ਼ਰੂਰ ਵਾਕਿੰਗ ਕਰਨ ਜਾਂਦਾ ਹਾਂ ਤਾਂ ਦੌੜਦਾ ਹਾਂ ਜਿਸ ਨਾਲ ਮੇਰਾ ਸਰੀਰ ਅਤੇ ਸਿਹਤ ਬੋਡੀ ਤੰਦਰੁਸਤ ਰਹਿੰਦੀ ਹੈ ਅਤੇ ਅਤੇ ਸਰੀਰ ਵੀ ਵਧੀਆ ਰਹਿੰਦਾ ਜਿਹਦੇ ਨਾਲ ਕਰਕੇ ਮਹਿਸੂਸ ਕੋਈ ਦਿੱਕਤ ਨਹੀਂ ਆਉਂਦੀ ਹੈਗੀ ਸਰੀਰ ਨੂੰ ਅਤੇ ਮਾਨਸਿਕ ਪਰੇਸ਼ਾਨੀ ਤੋਂ ਵੀ ਦੂਰ ਰਹਿੰਦਾ ਕਿਉਂਕਿ ਜਦੋਂ ਆਪਾਂ ਫਿਜੀਕਲ ਐਕਟੀਵਿਟੀ ਕਰਦੇ ਆ ਨਾ ਉਦੋਂ ਆਪਣਾ ਧਿਆਨ ਨਾ ਸਿਰਫ ਮੂਹਰੇ ਹੁੰਦਾ ਉਹ ਦੂਜੀ ਆਪਣੇ ਅੱਜ ਕੱਲ੍ਹ ਜ਼ਿੰਦਗੀ 'ਚ ਬੰਦਾ ਪਰੇਸ਼ਾਨ ਰਹਿੰਦਾ ਕੋਈ ਟੈਂਸ਼ਨ ਰਹਿੰਦੀ ਹੈ ਉਹ ਸਾਰੀਆਂ ਟੈਨਸ਼ਨਾਂ ਖੇਡਾਂ ਦੇ ਚੱਕਰ 'ਚ ਚੱਕੀਆਂ ਨੇ ਕਿਉਂਕਿ ਮਨ ਦੇ ਬੰਦੇ ਦਾ ਉੱਧਰ ਹੀ ਧਿਆਨ ਆਉਂਦਾ ਅਤੇ ਉਸ ਤੋਂ ਬਾਅਦ ਐਨਾ ਸੋਹਣਾ ਮਹਿਸੂਸ ਕਰਦਾ ਬੰਦੇ ਨੂੰ ਸਾਹ ਚੜ੍ਹ ਜਾਂਦਾ ਐਕਸਾਈਜ਼ ਕਰ ਲੈਂਦਾ ਵਾਰਮ ਅੱਪ ਹੋ ਜਾਂਦਾ ਉਸ ਤੋਂ ਬਾਅਦ ਉਹ ਥਕਾਵਟ ਜਿਹੀ ਥੋੜ੍ਹੀ ਜਿਹੀ ਮਹਿਸੂਸ ਹੁੰਦੀ ਹੈ ਪਰ ਇੱਕ ਇਹ ਵੀ ਆ ਨਾ ਥਕਾਵਟ ਦੇ ਨਾਲ ਫਿਰ ਜਦੋਂ ਸ਼ਾਮ ਨੂੰ ਬੰਦਾ ਸੌਂਦਾ ਨੀਂਦ ਬਹੁਤ ਸੋਹਣੀ ਆਉਂਦੀ ਹੈ ਉਹਨੂੰ ਖਾਣ ਲਈ ਖੁਰਾਕ ਬਹੁਤ ਸੋਹਣੀ ਉਹਦਾ ਦਿਲ ਕਰਦਾ ਕਿ ਯਾਰ ਮੇਰਾ ਪੇਟ ਜਿਹਾ ਖਾਲੀ ਹੋ ਗਿਆ ਕਿ ਭੱਜਦੇ ਰਹੀਏ ਅਤੇ ਉਦੂ ਬਾਅਦ ਕੁਛ ਨਾ ਕੁਛ ਖਾਂਦੇ ਰਹੀਏ ਉਹ ਆ ਅਤੇ ਮੈਂ ਇੱਕ ਚੀਜ਼ ਹੋਰ ਵੀ ਨੋਟ ਕੀਤੀ ਆ ਸਰਦੀਆਂ ਵਿੱਚ ਖਾਸਕਰ ਜਿਵੇਂ ਆਪਾਂ ਨੂੰ ਜੁਕਾਮ ਲੱਗ ਗਿਆ ਹਾਂ ਮਾੜਾ ਮੋਟਾ ਜੁਕਾਮ ਲੱਗ ਜਾਂਦਾ ਜਦੋਂ ਆਪਾਂ ਦੌੜਦੇ ਹਾਂ ਇਹ ਚੀਜ਼ ਵੱਲ ਧਿਆਨ ਦੇਈਏ ਦਵਾਈ ਨੂੰ ਘਟਾ ਦੇਈਏ ਤਾਂ ਆਪਣਾ ਨਾ ਇਹ ਆਟੋਮੈਟਿਕ ਇਹੋ ਜਿਹੀਆ ਚੀਜ਼ਾਂ ਠੀਕ ਰਹਿੰਦੀਆਂ ਨੇ ਆਪਣੀਆਂ ਨੇ ਇਸ ਲਈ ਮੈਂ ਤਾਂ ਇਹੀ ਸਲਾਹ ਦਿੰਦਾ ਕਿ ਵਾਕਿੰਗ ਅਤੇ ਆਹ ਦੌੜਨਾ ਹਰ ਇੱਕ ਨੂੰ ਚਾਹੀਦਾ ਜਿਹੜਾ ਸਿਹਤ ਆਪਣੀ ਸੈਟ ਰੱਖਦੀ ਆ ਰਹਿੰਦਾ ਆਪਣਾ ਅਤੇ ਮਾਨਸਿਕਤਾ ਆਪਣੇ ਸਾਰਾ ਕੁਛ ਸੈਟ ਰਹਿੰਦਾ ਇਹਦੇ ਨਾਲ